ਅਸੀਂ ਭੰਗੜੇ ਲਈ ਉਸ ਵਿਅਕਤੀ ਨੂੰ ਸਲਾਹ ਦੇਵਾਂਗੇ ਜੋ ਪਹਿਲੀ ਵਾਰ ਭੰਗੜਾ ਰੋਬਿਸ ਕਰਨ ਵਿੱਚ ਦਿਲਚਸਪੀ ਰੱਖੇਗਾ ਉਸਨੂੰ ਅਸੀਂ ਇਹ ਸਲਾਹ ਦੇਵਾਂਗੇ ਕਿ ਭੰਗੜਾ ਬਹੁਤ ਵਧੀਆ ਚੀਜ਼ ਹੈ ਇਸ ਨਾਲ ਮਨ ਵੀ ਖੁਸ਼ ਰਹਿੰਦਾ ਹੈ ਅਤੇ ਸਰੀਰ ਵੀ ਸਹੀ ਰਹਿੰਦਾ ਹੈ ਭੰਗੜਾ ਬਹੁਤ ਜ਼ਰੂਰੀ ਹੈ ਇਹ ਹਫਤੇ 'ਚ ਦੋ ਵਾਰੀ ਹੀ ਪਹਿਲੋਂ ਕਰਨਾ ਚਾਹੀਦਾ ਹੈ ਔਰ ਆਰਾਮ ਨਾਲ ਸਟੈਪ ਕਰਨੇ ਚਾਹੀਦੇ ਹਨ ਕਿਉਂਕਿ ਇਸ ਨਾਲ ਸਾਰਾ ਸਰੀਰ ਹਿਲਦਾ ਹੈ ਔਰ ਆਪਣੀ ਮਨ ਪਸੰਦ ਦੇ ਗਾਣੇ ਨਾਲ ਕਰਨਾ ਚਾਹੀਦਾ ਹੈ ਇਸ ਨਾਲ ਸਾਰਾ ਸਰੀਰ ਹਿਲਦਾ ਹੈ ਦੁਖਦਾ ਹੈ ਇਸ ਕਰਕੇ ਅਸੀਂ ਆਰਾਮ ਨਾਲ ਪਹਿਲੋਂ ਕਰਵਾਉਂਦੇ ਹਾਂ ਭੰਗੜਾ ਭੰਗੜਾ ਕਰਨ ਨਾਲ ਬੰਦੇ ਸਰੀਰ ਨੂੰ ਚੁਸਤੀ ਮਿਲਦੀ ਹੈ ਜਦੋਂ ਹੌਲੀ ਹੌਲੀ ਭੰਗੜਾ ਆ ਜਾਵੇ ਫਿਰ ਅਸੀਂ ਹਫਤੇ 'ਚ ਤਿੰਨ ਚਾਰ ਵਾਰੀ ਕਹਿ ਦਈਦਾ ਕਰਨ ਵਾਸਤੇ ਫਿਰ ਉਹ ਤਿੰਨ ਚਾਰ ਦਿਨ ਕਰਕੇ ਜਦੋਂ ਉਨ ਉਹਦੀ ਦਿਲਚਸਪੀ ਵੱਧ ਜਾਂਦੀ ਹੈ ਅਤੇ ਉਸਦਾ ਦਿਮਾਗ ਵੀ ਸਹੀ ਪਾਸੇ ਲੱਗ ਜਾਂਦਾ ਹੈ ਕਈ ਟੈਂਸ਼ਨਾਂ 'ਚੋਂ ਨਿਕਲ ਜਾਂਦਾ ਹੈ ਜਦੋਂ ਇਹ ਭੰਗੜਾ ਕਰਨ ਲੱਗ ਜਾਂਦਾ ਹੈ ਤਾਂ ਇਸ ਨੂੰ ਬਹੁਤ ਅੱਛਾ ਲੱਗਦਾ ਹੈ ਭੰਗੜਾ ਕਰਨ ਨਾਲ ਸਰੀਰ ਦਾ ਅੰਗ ਅੰਗ ਹਿਲਦਾ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ